ਹਾਂਜੀ ਹੁਨਰ ਵਿਸ਼ੇਸ਼ ਹੁਨਰ ਜ ਮੇਰਾ ਜਿਹੜਾ ਟੀਚਿੰਗ ਦਾ ਹੈਗਾ ਮੈਂ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹਾਂ ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੋ ਮੇਰੇ ਕੋਲ ਹੈ ਮੈਂ ਵੱਧ ਤੋਂ ਵੱਧ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਵਿਦਿਆਰਥੀਆਂ ਨੂੰ ਉਸ ਬਾਰੇ ਜਾਣਕਾਰੀ ਦੇ ਸਕਾਂ ਜਿਹੜਾ ਟੋਪਿਕ ਮੈਂ ਪੜ੍ਹਾ ਰਿਹਾ ਪਹਿਲਾਂ ਮੈਂ ਦਸ ਕਿਤਾਬਾਂ ਦੇ ਵਿੱਚੋਂ ਪੜ੍ਹਦਾ ਹਾਂ ਅਤੇ ਫਿਰ ਵਿਦਿਆਰਥੀਆਂ ਨੂੰ ਪੜਾਉਂਦਾ ਹਾਂ ਅਤੇ ਫਿਰ ਵਿਦਿਆਰਥੀਆਂ ਨੂੰ ਉਹਨਾਂ ਦੇ ਬਾਰੇ ਕੌਸ਼ਚਨ ਪੁੱਛਦਾ ਹਾਂ ਤਾਂ ਜੋ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੋ ਸਕੇ